ਪਟਿਆਲਾ ਜ਼ਿਲ੍ਹਾ ਦਿਨੋਂ ਦਿਨ ਤਰੱਕੀ ਦੇ ਰਾਹ 'ਤੇ ਚੱਲਦਾ ਜਾ ਰਿਹਾ ਹੈ ਇਸ ਜ਼ਿਲ੍ਹੇ ਦੇ ਨੌਜਵਾਨ ਨਵੇਂ ਤੋਂ ਨਵੇਂ ਕੰਮ ਲੱਭਦੇ ਰਹੇ ਲੱਭ ਰਹੇ ਹਨ ਤਾਂ ਜੋ ਆਪਣੇ ਫਿਊਚਰ ਨੂੰ ਚੰਗਾ ਚੰਗਾ ਬਣਾ ਸਕਣ ਇਸ ਲਈ ਬਹੁਤ ਅਨੇਕ ਤਰ੍ਹਾਂ ਦੇ ਢੰਗ ਅਪਣਾਉਂਦੇ ਹਨ ਕਈ ਨਵੇਂ ਕਿੱਤੇ ਵੀ ਚੱਲ ਪਏ ਹਨ ਜਿਵੇਂ ਕਿ ਮੇਕਅਪ ਆਰਟਿਸਟ ਦਾ ਕੰਮ ਬਹੁਤ ਚੱਲ ਪਿਆ ਹੈ ਪਟਿਆਲਾ ਜ਼ਿਲ੍ਹੇ ਵਿੱਚ ਮੁੰਡੇ ਬਹੁਤ ਮੇਕਅਪ ਆਰਟਿਸਟ ਦਾ ਕੰਮ ਸਿੱਖ ਰਹੇ ਹਨ ਅਤੇ ਬਹੁਤ ਜ਼ਿਆਦਾ ਸੈਲੂਨ ਵੀ ਖੁੱਲ੍ਹ ਰਹੇ ਹਨ ਇਹ ਕੰਮ ਬਹੁਤ ਹੀ ਜ਼ਿਆਦਾ ਚ ਤਰੱਕੀ ਦੇ ਰਾਹ 'ਤੇ ਹੈ ਇਸ ਕੰਮ ਕਰਨਾ ਬਹੁਤ ਹੀ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ ਅਤੇ ਉਹਨਾਂ ਨੂੰ ਦੇ ਘਰ ਦੀ ਰੋਟੀ ਚ ਚੱਲਣੀ ਸੌਖੀ ਹੋ ਗਈ ਹੈ ਬਹੁਤ ਜ਼ਿਆਦਾ ਨੌਜਵਾਨ ਇਹ ਕੰਮ ਸਿੱਖ ਰਹੇ ਹਨ ਇਹ ਕੰਮ ਸਿੱਖ ਕੇ ਉਹਨਾਂ ਦੇ ਘਰ ਦਾ ਗੁਜ਼ਾਰਾ ਚੰਗਾ ਚੱਲਣ ਲੱਗ ਪਿਆ ਹੈ ਇਹ ਕੰਮ ਵਿੱਚ ਉਹਨਾਂ ਨੂੰ ਚੰਗੀ ਕਮਾਈ ਹੋ ਜਾਂਦੀ ਹੈ ਇਹ ਕੰਮ ਵਿੱਚ ਬਹੁਤ ਜਿ ਜ਼ਿਆਦਾ ਫਾਇਦਾ ਹੈ ਕਿਉਂਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਸਾਰੀ ਹਰ ਕੋਈ ਮੁੰਡਾ ਜਾਂ ਕੁੜੀ ਹੋਵੇ ਸਾਰੇ ਮੇਕਅਪ ਦੇ ਬਹੁਤ ਇਛੁੱਕ ਹਨ ਇਸ ਕੰਮ ਵਿੱਚ ਬਹੁਤ ਚੰਗੀ ਕਮਾਈ ਹੈ ਅਤੇ ਚੰਗੇ ਪੈਸੇ ਬਣ ਜਾਂਦੇ ਹਨ ਇਸ ਲਈ ਸਾਰੇ ਨੌਜਵਾਨ ਪੀੜ੍ਹੀ ਇਸ ਪਾਸੇ ਜਾ ਰਹੀ ਹੈ ਹਰ ਕੋਈ ਆਪਣਾ ਇਹ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਅਤੇ ਮੁੰਡੇ ਕੁੜੀਆਂ ਸਭ ਇਹ ਕੰਮ ਸਿੱਖ ਰਹੇ ਹਨ ਮੇਕਅਪ ਦਾ ਕੰਮ ਸਿੱਖ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੈ ਇਸ ਕੰਮ ਵਿੱਚ ਕਮਾਈ ਬਹੁਤ ਜ਼ਿਆਦਾ ਹੈ ਇਹ ਕੰਮ ਪਟਿਆਲੇ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ ਹੈ ਇਸ ਲਈ ਬਹੁਤ ਸਲਿਊਨ ਵੀ ਪਟਿਆਲੇ ਵਿੱਚ ਖੁੱਲ੍ਹ ਚੁੱਕੇ ਹਨ ਇਹਨਾਂ ਸਲੂਨਾਂ ਵਿੱਚ ਅਨੇਕਾਂ ਹੀ ਪਿੰਡਾਂ ਦੇ ਮੁੰਡੇ ਵੀ ਕੁੜੀਆਂ ਅਤੇ ਮੁੰਡੇ ਬਹੁਤ ਜ਼ਿਆਦਾ ਕੰਮ ਕਰ ਰਹੇ ਹਨ ਅਤੇ ਸਿੱਖ ਰਹੇ ਹਨ ਅਤੇ ਕੰਮ ਸਿੱਖ ਕੇ ਆਪਣਾ ਕੰਮ ਸ਼ੁਰੂ ਕਰ ਰਹੇ ਹਨ ਕਿਉਂਕਿ ਅੱਜ ਦੇ ਟਾਈਮ ਵਿੱਚ ਮੇਕਅਪ ਦਾ ਬਹੁਤ ਕਰੇਜ ਚੱਲ ਪਿਆ ਹੈ ਹਰ ਕੋਈ ਮੇਕਅਪ ਕਰਵਾਉਣ ਲਈ ਇਹਨਾਂ ਕੋਲ ਆਉਂਦਾ ਹੈ ਇਸ ਲਈ ਇਹਨਾਂ ਦਾ ਕੰਮ ਵਧੀਆ ਚੱਲ ਰਿਹਾ ਅਤੇ ਕਈ ਨੌਜਵਾਨ ਗੌਰਮੈਂਟ ਜੋਬ ਵਿੱਚ ਵੀ ਜਾ ਰਹੇ ਹਨ ਸਰਕਾਰ ਭਗਵੰਤ ਮਾਨ ਦੀ ਸਰਕਾਰ ਇਸ ਵਿੱਚ ਅਨੇਕਾਂ ਹੀ ਨੌਜਵਾਨ ਇਸ ਲਈ ਬਹੁਤ ਜ਼ਿਆਦਾ ਗੌਰਮੈਂਟ ਜੋਬ ਵਿੱਚ ਵੀ ਜਾ ਰਹੇ ਹਨ ਇਹਨਾਂ ਸਹੂਲਤਾਂ ਕਰਕੇ ਉਹਨਾਂ ਨੂੰ ਘਰ ਚਲਾਉਣਾ ਸੌਖਾ ਹੋ ਗਿਆ ਹੈ ਬਹੁਤ ਜ਼ਿਆਦਾ ਨੌਜਵਾਨ ਗੌਰਮੈਂਟ ਜੋਬ ਵਿੱਚ ਜਾ ਰਹੇ ਹਨ ਇਹ ਸਭ ਕੁਝ ਆਪ ਸਰਕਾਰ ਕਿਉਂਕਿ ਭਗਵੰਤ ਮਾਨ ਬਹੁਤ ਪੋਸਟਾਂ ਕੱਢ ਰਿਹਾ ਹੈ ਇਸ ਲਈ ਉਹਨਾਂ ਨੂੰ ਨੌਜਵਾਨਾਂ ਨੂੰ ਨੌਕਰੀ ਮਿਲ ਰਹੀ ਹੈ ਅਤੇ ਕੋਨਸਟਰਕਸ਼ਨ ਵਰਕਰ ਦਾ ਕੰਮ ਵੀ ਬਹੁਤ ਚੱਲ ਰਿਹਾ ਹੈ ਪਟਿਆਲੇ ਵਿੱਚ ਬਹੁਤ ਜ਼ਿਆਦਾ ਨਵੇਂ ਘਰ ਬਣ ਰਹੇ ਹਨ ਜਿਸ ਕਾਰਨ ਬਹੁਤ ਹੀ ਰੁਜ਼ਗਾਰ ਵਧਿਆ ਹੋਇਆ ਹੈ ਮਿਸਤਰੀਆਂ ਦਾ ਕੰਮ ਵਧੀਆ ਚੱਲ ਰਿਹਾ ਹੈ ਅੱਜ ਦੇ ਟਾਈਮ ਵਿੱਚ ਹਰ ਇੱਕ ਨਵਾਂ ਘਰ ਪਾਉਣ ਲਈ ਕਾਹਲਾ ਹੋ ਹੋ ਰਿਹਾ ਹਰ ਕੋਈ ਨਵਾਂ ਘਰ ਪਾ ਰਿਹਾ ਕੋਠੀ ਪਾ ਰਿਹਾ ਇਸ ਕਰਕੇ ਕੰਨਟ੍ਰਕਸ਼ਨ ਦਾ ਕੰਮ ਮਿਸਤਰੀ ਕਰਦੇ ਮਿਸਤਰੀਆਂ ਨੂੰ ਰੋਜ਼ਗਾਰ ਮਿਲਿਆ ਹੋਇਆ ਅਤੇ ਲੇਬਰਾਂ ਲੇਬਰ ਵਾਲਿਆਂ ਨੂੰ ਵੀ ਬਹੁਤ ਰੋਜ਼ਗਾਰ ਮਿਲਿਆ ਹੋਇਆ ਹੈ ਉਹਨਾਂ ਦੀ ਚੰਗੀ ਦਿਹਾੜੀ ਬਣ ਜਾਂਦੀ ਹੈ ਉਹਨਾਂ ਦੇ ਘਰ ਦੀ ਰੋਟੀ ਚਲਾਉਣੀ ਸੌਖੀ ਹੋ ਗਈ ਹੈ ਇਹ ਕੰਮ ਬਹੁਤ ਚੱਲ ਰਿਹਾ ਹੈ ਪਟਿਆਲੇ ਵਿੱਚ ਇਸ ਕੰਮ ਰਾਹੀਂ ਸ਼ਹਿਰ ਦੀ ਤਰੱਕੀ ਵੀ ਹੋ ਰਹੀ ਹੈ ਅਤੇ ਲੋਕਾਂ ਦੀ ਆਰਥਿਕ ਵਿਵਸਥਾ ਵੀ ਠੀਕ ਹੋ ਰਹੀ ਹੈ ਇਹ ਲੋਕਾਂ ਦੇ ਜੀਵਨ ਢੰਗ ਵਿੱਚ ਜੀਵਨ ਵਿੱਚ ਆਰਥਿਕ ਯੋਗਦਾਨ ਵੀ ਪਾਉਂਦੇ ਹਨ ਕਿਉਂਕਿ ਇਹਨਾਂ ਨਾਲ ਉਹਨਾਂ ਦਾ ਘਰ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਹੈ ਅਤੇ ਨੌਜਵਾਨ ਨਸ਼ਿਆਂ ਵੱਲ ਨਹੀਂ ਜਾਂਦੇ ਹਨ